ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਨੀਆ ਪੰਜ ਡਿਸਟ੍ਰਿਕਟ ਨਾਮ ਜੋ ਕਿ ਮੈਨੂੰ ਚੇਤਾ ਹਨ ਪਹਿਲੀ ਹੈ ਫਰੀਦਕੋਟ ਦੂਜੀ ਬਰਨਾਲਾ ਤੀਜੀ ਮੋਗਾ ਚੌਥੀ ਫਤਿਹਗੜ੍ਹ ਸਾਹਿਬ ਅਤੇ ਆਖਰੀ ਜੋ ਕਿ ਪੰਜਵੀਂ ਹੈ ਉਹ ਹੈ ਬਠਿੰਡਾ